ਮੈਂ ਅਤੇ ਮੇਰਾ ਦੋਸਤ ਇੱਕ ਯਾਤਰਾ ਦੇ ਲਈ ਸ਼੍ਰੀਨਗਰ ਜਾਣਾ ਚਾਹੁੰਦੇ ਹਾਂ ਇਸ ਲਈ ਸਾਨੂੰ ਕਾਰ ਦੀ ਲੋੜ ਹੈ ਜੋ ਕਿ ਅਸੀਂ ਆਪ ਚਲਾਉਣੀ ਹੈ ਅਤੇ ਕਿਰਾਏ 'ਤੇ ਪ੍ਰਾਪਤ ਕਰਨੀ ਹੈ ਇਸ ਕਿਰਾਏ ਦੀ ਪ੍ਰਤੀ ਕਿਲੋਮੀਟਰ ਕੀਮਤ ਦੱਸਣ ਦੀ ਖੇਚਲ ਕੀਤੀ ਜਾਵੇ ਜੀ ਅਤੇ ਇਸ ਦੇ ਦਸਤਾਵੇਜ਼ਾਂ ਸਬੰਧੀ ਵੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਉਹ ਹਰ ਪੱਖੋਂ ਟ੍ਰੈਫਿਕ ਨਿਯਮਾਂ ਅਨੁਸਾਰ ਹਨ